ਸਾਡੇ ਪਿੰਡ ਵਿੱਚ ਇੱਕ ਲਾਈਬ੍ਰੇਰੀ ਹੈ ਅਤੇ ਇੱਥੇ ਭਿੰਨ ਭਿੰਨ ਪ੍ਰਕਾਰ ਦੀਆਂ ਕਿਤਾਬਾਂ ਹਨ ਜਿਵੇਂ ਚੁਟਕਲੇ ਹੋ ਗਏ ਰਸਾਲੇ ਹੋ ਗਏ ਕਹਾਣੀਆਂ ਦੀਆਂ ਕਿਤਾਬਾਂ ਕਵਿਤਾਵਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਲੇਖਕਾਂ ਦੀਆਂ ਕਹਾਣੀਆਂ ਹਨ ਸ਼ੇਕਸਪੀਅਰ ਹੋ ਗਏ

ਅਲੱਗ ਹੀ ਅੰਦਰੋਂ ਖੁਸ਼ੀ ਮਿਲਦੀ ਅਤੇ ਜਿਹੜਾ ਤੁਹਾਡਾ ਵਿਹਲਾ ਜਿਹੜਾ ਵਿਹਲਾ ਸਮਾਂ ਹੈ ਉਹ ਵੀ ਬਤੀਤ ਹੋ ਜਾਂਦਾ ਅਤੇ ਉਹ ਵੀ ਖਰਾਬ ਨਹੀਂ ਜਾਂਦਾ ਅਤੇ ਜਦੋਂ ਕਹਾਣੀ ਪੜ੍ਹਦੇ ਤਾਂ ਚੁਟਕਲੇ ਅਲੱਗ ਅਲੱਗ ਤਰ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਇਉਂ ਜਿਵੇਂ ਕਿ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੋ ਗਈ ਇਹ ਇੱਦਾਂ ਦੀ ਕਿਤਾਬਾਂ ਪ ਅ ਕਵਿਤਾਵਾਂ ਪੜ੍ਹ ਕੇ ਵੀ ਅਲੱਗ ਹੀ ਖੁਸ਼ੀ ਮਿਲਦੀ ਹੈ ਅਤੇ ਕਿਤਾਬਾਂ ਜਦੋਂ ਕਿਤਾਬਾਂ ਸਾਨੂੰ ਅਲੱਗ ਅਲੱਗ ਤਰ੍ਹਾਂ ਦੀ ਨੌਲੇਜ ਦਿੰਦੀਆਂ ਕਿਸੇ ਵੀ ਤਰ੍ਹਾਂ ਦੀ ਕਿਤਾਬ ਹੋ ਗਈ ਕੋਈ ਨੋਲੇਜ ਵਾਲੀ ਬੁੱਕ ਅਲੱਗ ਤਰ੍ਹਾਂ ਦੀ ਨੋਲੇਜ ਹਰ ਇੱਕ ਕਿਤਾਬ ਤੋਂ ਚਾਹੇ ਕੋਈ ਕਹਾਣੀ ਵਾਲੀ ਹੈ ਚਾਹੇ ਕੋਈ ਕਵਿਤਾ ਵਾਲੀ ਹੈ ਇਹ ਜਦੋਂ ਸਾਨੂੰ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਅਤੇ ਇਸ ਲਈ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜਿਆਦਾ ਸ਼ੌਕ ਹੈ ਕਿਉਂਕਿ ਜਦੋਂ ਨਵੀਂ ਨਵੀਂ ਚੀਜ਼ ਸਿੱਖਦੀ ਤਾਂ ਉਹ ਨਾਲ ਅਲੱਗ ਖੁਸ਼ੀ ਹੁੰਦੀ ਹੈ ਅਤੇ ਮੈਨੂੰ ਕਿਤਾਬਾਂ ਪੜ੍ਹਨ ਦਾ ਇਸ ਲਈ ਬਹੁਤ ਜ਼ਿਆਦਾ ਸ਼ੌਕ ਹੈ